ਰੋਜ਼ਾਨਾ ਦੀ ਜ਼ਿੰਦਗੀ ਵਿੱਚ ਔਰਤਾਂ ਨੂੰ ਬਹੁਤ ਸਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਲੇਕਿਨ ਪਹਿਲੇ ਸਮੇਂ ਦੀ ਜੇ ਗੱਲ ਕੀਤੀ ਜਾਵੇ ਤਾਂ ਉਸ ਟਾਈਮ ਉਹਨਾਂ ਨੂੰ ਕੁੱਝ ਜ਼ਿਆਦਾ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਇੱਕ ਤਾਂ ਉਹਨਾਂ ਨੂੰ ਪੜ੍ਹਾਇਆ ਲਿਖਾਇਆ ਬਹੁਤ ਘੱਟ ਜਾਂਦਾ ਸੀਗਾ ਕੋਈ ਕੋਈ ਹੀ ਪਰਿਵਾਰ ਹੁੰਦੇ ਸੀਗੇ ਜਿਹੜੇ ਕੁੜੀਆਂ ਨੂੰ ਸ਼ਿਕਸ਼ਾ ਦੇਣੀ ਜ਼ਰੂਰੀ ਸਮਝਦੇ ਸੀ ਨਹੀਂ ਤਾਂ ਜ਼ਿਆਦਾਤਰ ਜਿਹੜੇ ਲੋਕ ਸੀਗੇ ਉਹ ਸਮਝਦੇ ਹੀ ਨਹੀਂ ਸੀਗੇ ਕਿ ਕੁੜੀਆਂ ਵਾਸਤੇ ਵੀ ਸ਼ਿਕਸ਼ਾ ਜਿਹੜੀ ਹੈ ਪੜ੍ਹਾਈ ਜਿਹੜੀ ਉਹ ਬਹੁਤ ਜ਼ਰੂਰੀ ਹੈ ਅਤੇ ਉਸ ਟਾਇਮ ਕੁੜੀਆਂ ਨੂੰ ਜ਼ਿਆਦਾਤਰ ਘਰਾਂ ਦੇ ਅੰਦਰ ਹੀ ਰੱਖਿਆ ਜਾਂਦਾ ਸੀਗਾ ਉਹਨਾਂ ਨੂੰ ਬਾਹਰ ਕੱਢਣ ਕੱਢਿਆ ਨਹੀਂ ਸੀ ਜਾਂਦਾ ਉਹਨਾਂ ਨੂੰ ਪਰਦੇ ਦੇ ਵਿੱਚ ਰੱਖਿਆ ਜਾਂਦਾ ਸੀ ਲੇਕਿਨ ਅੱਜ ਦੇ ਸਮੇਂ ਵਿੱਚ ਜੇ ਦੇਖਿਆ ਜਾਵੇ ਤਾਂ ਕੁੜੀਆਂ ਨੂੰ ਕਾਫ਼ੀ ਜ਼ਿਆਦਾ ਆਜ਼ਾਦੀ ਦਿੱਤੀ ਗਈ ਹੈ ਉਹਨਾਂ ਨੂੰ ਸ਼ਿਕਸ਼ਾ ਦਾ ਵੀ ਅਧਿਕਾਰ ਮਿਲਿਆ ਏ ਅੱਜਕੱਲ੍ਹ ਜਿਹੜੀ ਹਰੇਕ ਕੁੜੀ ਹੈਗੀ ਹੈ ਉਹ ਪੜ੍ਹ ਰਹੀ ਹੈ ਅਤੇ ਪੜ੍ਹ ਲਿਖ ਕੇ ਬਹੁਤ ਕੁਝ ਕਰ ਵੀ ਰਹੀ ਹੈ ਉਹ ਆਰਥਿਕ ਰੂਪ 'ਤੇ ਆਪਣੇ ਪੈਰਾਂ 'ਤੇ ਵੀ ਖੜੀ ਹੈ ਉਹ ਦੇਸ਼ ਦੇ ਵਿੱਚ ਵੀ ਬਹੁਤ ਸਾਰੇ ਕੰਮਾਂ ਵਿੱਚ ਯੋਗਦਾਨ ਦੇ ਰਹੀ ਹੈ ਅਤੇ ਅੱਜ ਦਾ ਜਿਹੜਾ ਸਮਾਜ ਹੈ ਉਹ ਔਰਤਾਂ ਦੀ ਭੂਮਿਕਾ ਵਿੱਚ ਨੂੰ ਨਕਾਰ ਨਹੀਂ ਸਕਦਾ ਔਰਤਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਸਮਾਜ ਨੂੰ ਬਦਲ ਰਹੀਆਂ ਨੇ ਅਤੇ ਇਹ ਬਦਲਾਵ ਜਿਹੜਾ ਏ ਬਹੁਤ ਜ਼ਰੂਰੀ ਵੀ ਹੈਗਾ ਅੱਜ ਦੇ ਸਮਾਜ ਦੇ ਲਈ